ਵੈਸੇ ਤਾਂ ਮੈਨੂੰ ਡਾਂਸ ਕਰਨਾ ਬਹੁਤ ਪਸੰਦ ਆ ਅਤੇ ਮੈਂ ਹਰ ਇੱਕ ਕੋਂਪੀਟੀਸ਼ਨ 'ਚ ਹਰ ਇੱਕ ਪ੍ਰੋਗਰਾਮ 'ਚ ਡਾਂਸ ਪੇਸ਼ ਕਰਦੀ ਕਰਦੀ ਹਾਂ ਆਪਣਾ ਬਣਾ ਕੇ ਆਪ ਪ੍ਰੈਕਟਿਸ ਕਰਕੇ ਘਰੇ ਬਟ ਮੈਨੂੰ ਮੇਰੇ ਲਈ ਸਭ ਤੋਂ ਯਾਦਗਾਰ ਜਿਹੜਾ ਹੈਗਾ ਵਾ ਨਾ ਉਹ ਸਾਡੀ ਇੱਕ ਸੰਸਥਾ ਆ ਡੀ ਜੇ ਜੇ ਐੱਸ ਸੰਸਥਾ ਉੱਥੇ ਸਾਨੂੰ ਮੈਨੂੰ ਸਲੈਕਟ ਕੀਤਾ ਸੀਗਾ ਫਿਰ ਉਹਨਾਂ ਨੇ ਨਾ ਸਾਨੂੰ ਡਾਂਸ ਸਿਖਾਇਆ ਜਿਵੇਂ ਕਿ ਕੱਥਕ ਸ ਸਿਖਾਇਆ ਸ਼ਿਵ ਤਾਂਡਵ ਸਿਖਾਇਆ ਫਿਰ ਅਸੀਂ ਉੱਥੇ ਮਤਲਬ ਕਿ ਉੱਥੇ ਮੇਰੀਆਂ ਬਹੁਤ ਸਾਰੀਆਂ ਫ੍ਰੈਂਡਸ ਬਣੀਆਂ ਫਿਰ ਉਹਨਾਂ ਨਾਲ ਹਾਸਾ ਮਜ਼ਾਕ ਕਰਨਾ ਫਿਰ ਉਹ ਸਾਨੂੰ ਬਰੇਕ ਵੀ ਦਿੰਦੇ ਹੁੰਦੇ ਸੀਗੇ ਵਿੱਚ ਫਿਰ ਉਹ 'ਚ ਸਾਨੂੰ ਉਹਨਾਂ ਨੇ ਚਾਹ ਪਿਲਾਉਣੀ ਖਾਣਾ ਪੀਣਾ ਸਾਰਾ ਕਰਨਾ ਬਹੁਤ ਬਹੁਤ ਟਾਈਮ ਤੱਕ ਸਾਡੀ ਪ੍ਰੈਕਟਿਸ ਹੁੰਦੀ ਰਹਿੰਦੀ ਸੀ ਕਦੇ ਕਦੇ ਤਾਂ ਰਾਤ ਵੀ ਹੁੰਦੀ ਸੀਗੀ ਬੜਾ ਇੰਜੋਏ ਕਰਦੇ ਹੁੰਦੇ ਸੀ ਪ੍ਰੈਕਟਿਸ ਕਰਦੇ ਕਰਦੇ ਸਾਡੇ ਖੱਲੀਆਂ ਵੀ ਪੈ ਜਾਂਦੀਆਂ ਸੀਗੀਆਂ ਬਟ ਉਹ ਚੀਜ਼ ਸਾਨੂੰ ਚੁਭਦੀ ਨਹੀਂ ਸੀ ਕਿਉਂਕਿ ਉੱਥੇ ਅਸੀਂ ਇੰਜੋਏ ਵੀ ਬਹੁਤ ਕਰਦੇ ਸੀ ਅਤੇ ਸਾਨੂੰ ਡਾਂਸ ਕਰਨਾ ਬੜਾ ਪਸ ਮੈਨੂੰ ਵੈਸੇ ਵੀ ਡਾਂਸ ਕਰਨਾ ਬਹੁਤ ਪਸੰਦ ਹੈ ਇਸ ਕਰਕੇ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਸੀ ਫਰੈਂਡਸ ਦੇ ਨਾਲ ਘੁਲ ਮਿਲ ਕੇ ਫਿਰ ਅਸੀਂ ਫਿਰ ਅਸੀਂ ਬਹੁਤ ਪ੍ਰੈਕਟਿਸ ਕੀਤੀ ਮਤਲਬ ਕਿ ਉਹ ਬਹੁਤ ਉਹ ਸਾਡੇ ਲਈ ਮੇਰੇ ਲਈ ਤਾਂ ਬੜਾ ਔਖਾ ਸੀ ਕਿਉਂਕਿ ਮੈਂ ਕਦੇ ਇੱਦਾਂ ਸ਼ਿਵ ਤਾਂਡਵ ਵਗੈਰਾ ਇਹ ਚੀਜ਼ਾਂ ਨਹੀਂ ਕੀਤੀਆਂ ਫਿਰ ਉਹਨਾਂ ਨੇ ਸਾਡੀ ਡਰੈਸਿਸ ਵੀ ਉਹੋ ਜਿਹੀਆਂ ਬਣਵਾਈਆਂ ਫਿਰ ਸਾਡੇ ਮੱਥੇ 'ਤੇ ਤ੍ਰਿਕੁੰਡ ਲਗਾਇਆ ਸਾਨੂੰ ਪੂਰਾ ਮਤਲਬ ਕਿ ਉਸ ਵਿੱਚ ਤਿਆਰ ਕੀਤਾ ਕਿ ਜਿਸ ਤਰ੍ਹਾਂ ਕਿ ਆਪਾਂ ਬੋਲਦੇ ਹਾਂ ਕਿ ਸ਼ਿਵ ਤਾਂਡਵ ਹੁੰਦਾ ਆ ਜਿਵੇਂ ਕਿ ਫਿਰ ਉਹ ਕੀਤਾ ਫਿਰ ਜਿਸ ਦਿਨ ਸਾਡਾ ਸੀਗਾ ਨਾ ਪ੍ਰੋਗਰਾਮ ਉਸ ਦਿਨ ਅਸੀਂ ਸ਼ਿਵ ਤਾਂਡਵ ਕੀਤਾ ਸਾਰਿਆਂ ਨੇ ਮਤਲਬ ਕਿ ਬਹੁਤ ਪਸੰਦ ਕੀਤਾ ਉਹ ਸੌਂਗ ਵੀ ਬੜਾ ਮਤਲਬ ਕਿ ਉਹੋ ਜਿਹਾ ਸੀਗਾ ਕਿ ਸਾਨੂੰ ਪਹਿਲਾਂ ਮੰਤਰ ਯਾਦ ਕਰਨਾ ਪੈਂਦਾ ਸੀਗਾ ਫਿਰ ਉਹ ਯਾਦ ਕਰਕੇ ਫਿਰ ਉਹਦੇ 'ਤੇ ਸਟੈਪ ਸਿੱਖਣੇ ਪੈਂਦੇ ਸੀਗੇ ਇਹ ਸਟੈਪ ਅਤੇ ਇਹ ਸਟੈਪ ਹੁੰਦਾ ਵਾ ਫਿਰ ਉਹ ਮਤਲਬ ਕਿ ਉਹ ਪੂਰੀ ਚੀਜ਼ ਉਹ ਜਿਹੜਾ ਸਮਾਗਮ ਹੁੰਦਾ ਸੀ ਨਾ ਉਹ ਬੜਾ ਮਤਲਬ ਕਿ ਸਾਡੇ ਲਈ ਬਹੁਤ ਵਧੀਆ ਸੀ ਮੇਰੇ ਲਈ ਤਾਂ ਵੈਸੇ ਬਹੁਤ ਵਧੀਆ ਅਤੇ ਉਹ 'ਚ ਸਾਨੂੰ ਲਾਸਟ 'ਤੇ ਜਦੋਂ ਸਾਨੂੰ ਅਸੀਂ ਫਰਸਟ ਪੁਜੀਸ਼ਨ 'ਤੇ ਆਏ ਫਿਰ ਡਿਸਟਰਿਕਟ ਵਿੱਚੋਂ ਫਿਰ ਫਸਟ ਪੁਜ਼ੀਸ਼ਨ 'ਤੇ ਜਦੋਂ ਆਏ ਫਿਰ ਸਾਨੂੰ ਅਵਾਰਡ ਮਿਲਿਆ ਸਾਨੂੰ ਪ੍ਰਾਈਜ ਮਿਲੇ ਉਹ ਚੀਜ਼ ਉਹ ਜੋ ਵੀ ਹੋਇਆ ਨਾ ਉਹ ਦਿਲ 'ਚ ਬਹੁਤ ਮਾਇਨੇ ਰੱਖਦੀ ਆ ਮੇਰੇ ਲਈ ਇਸ